ਸ਼੍ਰੀ ਗੁਰੂ ਹਰ ਹਰਿਮੰਦਰ ਸਾਹਿਬ ਜਲਿਆਂਵਾਲਾ ਬਾਗ ਸ਼ੁਕਲਾ ਲੇਕ ਰੋਜ਼ ਗਾਰਡਨ ਰੋਕ ਗਾਰਡਨ ਦੁੱਖ ਨਿਵਾਰਨ ਸਾਹਿਬ ਬੋਧ ਮੰਦਰ ਧਰਮਸ਼ਾਲਾ ਵਰਿੰਦਾਵਨ ਜਗਨਨਾਥ ਪੁਰੀ ਰਘੁਨਾਥ ਮੰਦਰ ਬਾਲਾ ਸ ਬਾਲਾ ਜੀ ਸਾਲਾਸਰ ਧਾਮ ਜੰਤਰ ਮੰਤਰ ਹਵਾ ਮਹਿਲ ਇੰਡੀਆ ਗੇਟ ਗੇਟਵੇ ਆਫ ਇੰਡੀਆ ਤਾਜ ਮਹਿਲ ਧੰਨਵਾਦ